ਇੱਕ ਸੌ ਪਚਾਨਵੇਂ ਪੰਜ ਹਜ਼ਾਰ ਸੱਤ ਸੌ ਅੱਸੀ ਸੱਤਰ ਹਜ਼ਾਰ ਅੱਠ ਸੌ ਦਸ ਚਾਰ ਲੱਖ ਤੇਰ੍ਹਾਂ ਹਜ਼ਾਰ ਛੇ ਸੌ ਨੱਬੇ ਨੌ ਲੱਖ ਪਚਾਸੀ ਹਜ਼ਾਰ ਤਿੰਨ ਸੌ ਚਾਲੀ